ਮੇਰਾ ਬਚਪਨ ਵਿੱਚ ਹੀ ਖਾਣਾ ਪਕਾਉਣਾ ਇੱਕ ਸ਼ੌਂਕ ਬਣ ਗਿਆ ਹੈ ਮੈਨੂੰ ਖਾਣਾ ਪਕਾਉਣਾ ਪਕਾਉਣਾ ਵਿੱਚ ਬੜਾ ਮਜ਼ਾ ਆਉਂਦਾ ਹੈ ਇੱਕ ਵਾਰ ਸਾਡੇ ਘਰ ਵਿੱਚ ਪਾਰਟੀ ਸੀ ਮੈਂ ਭੋਜਨ ਆਪਣੇ ਹੱਥੀਂ ਤਿਆਰ ਕੀਤਾ ਸੀ ਪਹਿਲਾਂ ਮੈਂ ਛੋਲਿਆਂ ਨੂੰ ਰਾਤ ਹੀ ਭਿਉਂ ਲਿਆ ਸੀ ਅਤੇ ਆਲੂ ਮੈਂ ਉਬਾਲ ਕੇ ਰੱਖ ਲਏ ਸੀ ਸਬਜ਼ੀਆਂ ਕੱਟ ਕੇ ਰਾਤ ਹੀ ਰੱਖ ਲਈਆਂ ਸਨ ਮੇਰੇ ਕੋਲ ਚਾਰ ਚੁੱਲ੍ਹੇ ਵਾਲਾ ਗੈਸ ਹੈ ਇਸ ਤਰ੍ਹਾਂ ਮੈਂ ਜਲਦੀ ਹੀ ਕੰਮ ਕਰ ਲੈਂਦੀ ਹਾਂ ਜੇਕਰ ਮਿੱਠਾ ਬਣਾਉਣਾ ਹੋਵੇ ਤਾਂ ਅਸੀਂ ਚਾਸ਼ਣੀ ਬਣਾ ਕੇ ਆਟਾ ਮੈਂ ਵੱਖਰਾ ਭੁੰਨ ਲੈਂਦੀ ਹਾਂ ਫਿਰ ਇਸ ਤਰ੍ਹਾਂ ਮਿੱਠਾ ਬਣਾ ਲੈਂਦੀ ਹਾਂ ਚਾਵਲ ਅਸੀਂ ਰਾਤ ਹੀ ਸਾਫ਼ ਕਰ ਕੇ ਰਖ ਰੱਖੇ ਸਨ ਕੁੱਕਰ ਵਿੱਚ ਸੀਟੀ ਮਰਵਾ ਕੇ ਜਲਦੀ ਬਣ ਜਾਂਦੇ ਹਨ ਇਸ ਪ੍ਰਕਾਰ ਮੈਂ ਕੁਝ ਰਣਨੀਤੀਆਂ ਅਪਣਾ ਕੇ ਜਲਦੀ ਭੋਜਨ ਤਿਆਰ ਕਰ ਲੈਂਦੀ ਹਾਂ